ਸਾਡੇ ਖੇਤਰ ਵਿੱਚ ਵੀ ਸ਼ਿਲਪਕਾਰੀ ਦਾ ਇੱਕ ਕੈਂਪ ਲੱਗਿਆ ਸੀ ਜਿਸ ਵਿੱਚ ਉਹਨਾਂ ਨੇ ਅਲੱਗ ਅਲੱਗ ਸਮੱਗਰੀ ਨਾਲ ਜਿਵੇਂ ਕਿ ਮਿੱਟੀ ਕੱਪੜੇ ਅਲੱਗ ਅਲੱਗ ਪ੍ਰਕਾਰ ਦੀ ਚੀਜ਼ਾਂ ਦੇ ਨਾਲ ਸਾਨੂੰ ਸਿਖਲਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਸਾਰਾ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਆਪ ਹੀ ਆਯੋਜਿਤ ਕੀਤਾ ਸੀ ਅਤੇ ਇਹ ਸੰਚਾਰਣ ਵਿੱਚ ਅਗਰ ਅਸੀਂ ਆਪ ਮੈਂ ਆਪ ਸਿੱਖਣਾ ਚਾਹੁੰਦਾ ਤਾਂ ਮੈਂ ਆਪਣੇ ਸਾਥੀਆਂ ਦੀ ਮਦਦ ਲਵਾਂਗਾਂ ਆਪਣੇ ਟੀਚਰ ਦੀ ਮਦਦ ਲਵਾਂਗਾਂ ਅਗਰ ਮੈਨੂੰ ਉਨ੍ਹਾਂ ਦੀ ਮਦਦ ਨਹੀਂ ਮਿਲਦੀ ਤਾਂ ਮੈਂ ਜਿਹੜਾ ਕੈਂਪ ਲਾ ਰਹੇ ਉਨ੍ਹਾਂ ਦੇ ਹੈਡ ਕੋਲ ਜਾਵਾਂਗਾ ਉਨ੍ਹਾਂ ਤੋਂ ਮਦਦ ਲਵਾਂਗਾ ਅਤੇ ਮੇਰੀ ਸ਼ੁਰੂ ਤੋਂ ਹੀ ਇਹ ਸਰ ਸ਼ਿਲਪਕਾਰੀਆਂ ਦੇ ਰੁਚੀ ਰਹੀ ਸੀ ਮੇਰਾ ਬਚਪਨ ਤੋਂ ਹੀ ਇਹ ਇਹ ਚੀਜ਼ਾਂ ਕਰ ਰਿਹਾ ਹਾਂ ਅਤੇ ਮੈਂ ਆਰਟ ਐਂਡ ਕਰਾਫਟ ਅੰਦਰ ਵੀ ਮੇਰਾ ਕਾਫ਼ੀ ਰੁਚੀ ਰਹੀ ਹੈ ਮੈਂ ਕਾਫ਼ੀ ਪੇਂਟਿੰਗਸ ਬਣਾਈਆਂ ਨੇ ਫੁੱਲ ਬੂਟੇ ਸਾਰਾ ਕੁਛ ਮੈਂ ਬਣਾ ਲੈਂਦਾ ਹਾਂ ਅਤੇ ਇਸ ਹੁਨਰ ਦੇ ਅੰਦਰ ਮੇਰਾ ਸ਼ੁਰੂ ਤੋਂ ਹੀ ਕਾਫ਼ੀ ਰੁਚੀ ਰਹੀ ਹੈ ਅਗਰ ਸਾਡੇ ਖੇਤਰ ਵਿੱਚ ਇਹ ਤਰੀਕੇ ਦੇ ਕੈਂਪ ਲੱਗਦਾ ਹੈ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਮੈਂ ਉਹਦੇ ਵਿੱਚ ਹਿੱਸਾ ਲਵਾਂ ਅਤੇ ਚੰਗੀ ਤਰ੍ਹਾਂ ਆਪਦਾ ਯੋਗਦਾਨ ਦਵਾਂ